ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਰਜੀਤ ਕੌਰ ਪਠਾਨਕੋਟ ਤੋਂ ਬੋਲ ਰਹੀ ਹਾਂ ਜਿਸ ਤਰ੍ਹਾਂ ਸਾਡੇ ਪਠਾਨਕੋਟ ਇਲਾਕੇ ਦੇ ਵਿੱਚ ਦੇਖਣ ਯੋਗ ਬਹੁਤ ਸੋਹਣੀਆਂ ਜਗ੍ਹਾ ਹਨ ਜਿਵੇਂ ਕਿ ਮੁਕੇਸ਼ਵਰ ਧਾਮ ਰਣਜੀਤ ਸਾਗਰ ਡੈਮ ਮੁਕੇਸ਼ਵਰ ਧਾਮ ਰਣਜੀਤ ਸਾਗਰ ਰਣਜੀਤ ਸਾਗਰ ਡੈਮ ਇਹ ਕਾਫੀ ਮਤਲਬ ਖੂਬਸੂਰਤ ਜਗ੍ਹਾ ਮਿੰਨੀ ਗੋਆ ਜਿਸ ਤਰ੍ਹਾਂ ਮਿੰ ਲੋਕ ਮਿੰਨੀ ਗੋਆ 'ਚ ਜਾਂਦੇ ਹਨ ਉੱਥੇ ਲਾਗੇ ਨਹਿਰ ਹੈ ਬਣੀ ਹੋਈ ਹੈ ਅਤੇ ਦੇਖਣ ਨੂੰ ਉਹਨਾਂ ਦੀ ਲੋਕੇਸ਼ਨ ਬਹੁਤ ਵਧੀਆ ਲੱਗਦੀ ਹੈ ਬਹੁਤ ਰਮਨੀਕ ਸਥਾਨ ਹੈ ਜੋ ਲੋਕ ਦੇਖਣ ਆਉਂਦੇ ਹਨ ਜਿਸ ਤਰ੍ਹਾਂ ਕਿ ਮੁਕੇਸ਼ਵਰ ਧਾਮ ਆ ਉਹ ਇੱਕ ਸ਼ਿਵਜੀ ਦਾ ਬਣਿਆ ਹੋਇਆ ਇੱਕ ਮੰਦਰ ਹੈ ਜੋ ਕਿ ਲੋਕ ਆਸਥਾ ਰੱਖ ਕੇ ਉੱਥੇ ਮੱਥਾ ਟੇਕਣ ਆਉਂਦੇ ਹਨ ਅਤੇ ਨ ਨਤਮਸਤਕ ਹੁੰਦੇ ਹਨ ਅਤੇ ਬਹੁਤ ਰਮਨੀਕ ਦੇਖਣ ਨੂੰ ਬਹੁਤ ਰਮਨੀਕ ਸ ਸਥਾਨ ਹੈ ਜਿਵੇਂ ਕਿ ਰਣਜੀਤ ਸਾਗਰ ਡੈਮ ਹੈ ਉਹ ਕਾਫੀ ਬ ਬਹੁਤ ਵਧੀਆ ਲੱਗਦਾ ਲੋਕ ਰਣਜੀਤ ਸਾਗਰ ਡੈਮ ਨੂੰ ਵੀ ਦੇਖਣ ਆਉਂਦੇ ਹਨ